ਨਹੀਂ ਸਥਾਨਕ ਕਲਾਕਾਰ ਅਤੇ ਸ਼ਿਲਪਕਾਰ ਨੇ ਸਾਡੇ ਖੇਤਰ ਦੇ ਲੋਕਾਂ ਲਈ ਕੋਈ ਕੈਂਪ ਜਾਂ ਸਿਖਲਾਈ ਸੈਸ਼ਨ ਆਯੋਜਿਤ ਨਹੀਂ ਕੀਤਾ ਮੈਂ ਆਪਣੇ ਕਲਾ ਜ਼ਿਆਦਾ ਆਨਲਾਈਨ ਹੀ ਸਿੱਖੀ ਹੈ ਅਤੇ ਇਸ ਦੇ ਦੁਆਰਾ ਹੀ ਮੈਂ ਬਹੁਤ ਕੁਝ ਸਿੱਖ ਸਕਦੀ ਹਾਂ ਜੇਕਰ ਮੈਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਮੈਂ ਆਪਣੇ ਭਰਾ ਜਿਹੜਾ ਕਲਾ ਅਤੇ ਸ਼ਿਲਪਕਾਰ ਦੇ ਵਿੱਚ ਮਾਹਰ ਹੈ ਉਸ ਦੀ ਸਲਾਹ ਲੈ ਸਕਦੀ ਹਾਂ